ਮੋਹਾਲੀ ਜ਼ਿਲ੍ਹਾ ਹੈ ਜਿਹੜਾ ਹੈ ਉੱਥੇ ਪੇੜ ਪੌਦੇ ਬਹੁਤ ਜ਼ਿਆਦਾ ਹੈਗੇ ਨੇ ਅਤੇ ਇਸ ਕਰਕੇ ਉੱਥੇ ਬਾਰਿਸ਼ ਵੀ ਹ ਜ਼ਿਆਦਾ ਹੁੰਦੀ ਹੈ ਹੋਰ ਜ਼ਿਲ੍ਹਿਆਂ ਨਾਲੋਂ ਅਤੇ ਉੱਥੇ ਦਾ ਮੌਸਮ ਵੀ ਸੁਹਾਵਣਾ ਹੀ ਰਹਿੰਦਾ ਤਕਰੀਬਨ ਗਰਮੀ ਜਿਹੜੀ ਹੈ ਉਹ ਪਹਿਲੇ ਬਹੁਤ ਜ਼ਿਆਦਾ ਸੀਗੀ ਬਹੁਤ ਹੁੰਮਸ ਭਰੀ ਗਰਮੀ ਸੀਗੀ ਲੋਕ ਬੜੇ ਪ੍ਰੇਸ਼ਾਨ ਸੀਗੇ ਗਰਮੀ ਤੋਂ ਤਕਰੀਬਨ ਪੰਜ ਛੇ ਮਹੀਨੇ ਬਾਰਿਸ਼ ਵੀ ਹੁੰਦੀ ਰਹੀ ਹੈ ਲੇਕਿਨ ਉਹਦੇ ਬਾਵਜੂਦ ਵੀ ਗਰਮੀ ਜਿਹੜੀ ਸੀਗੀ ਉਹ ਬਹੁਤ ਹੀ ਬੇਹਾਲ ਕਰਦੀ ਰਹੀ ਹੈ ਲੋਕਾਂ ਨੂੰ ਪਰ ਹੁਣ ਜਿਹੜਾ ਹੈ ਉਹ ਮੌਸਮ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਸਵੇਰੇ ਸ਼ਾਮ ਦੀ ਠੰਡ ਹੋਣ ਲੱਗ ਗਈ ਹੈ ਅਤੇ ਬੱਚਿਆਂ ਵਾਸਤੇ ਤਕਰੀਬਨ ਠੰਡ ਸ਼ੁਰੂ ਵੀ ਹੋ ਗਈ ਹੈ ਅਤੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਠੰਡ ਤੋਂ ਬਚਾ ਕੇ ਵੀ ਰੱਖਿਆ ਜਾਣਾ ਚਾਹੀਦਾ ਹੈ ਹੁਣ ਅਤੇ ਜਿਹੜਾ ਉੱਥੇ ਦਾ ਮੌਸਮ ਹੈਗਾ ਹੈ ਉਹ ਕਾਫ਼ੀ ਬਦਲਦਾ ਹਰ ਜਗ੍ਹਾ ਦਾ ਹੀ ਮੌਸਮ ਜਿਹੜਾ ਹੈ ਉਹ ਇਸ ਮਹੀਨੇ ਵਿੱਚ ਆ ਕੇ ਬਦਲਣ ਲੱਗ ਜਾਂਦਾ ਹੈ ਜਿਵੇਂ ਸਰਦੀਆਂ ਸ਼ੁਰੂ ਹੋਣੀਆਂ ਲੱਗ ਜਾਂਦੀਆਂ ਨੇ ਦਿਨ ਵੀ ਛੋਟੇ ਹੋਣ ਲੱਗ ਜਾਂਦੇ ਨੇ ਅਤੇ ਰਾਤਾਂ ਲੰਬੀਆਂ ਹੋਣ ਲੱਗ ਜਾਂਦੀਆਂ ਅਤੇ ਪੇੜ ਪੌਦੇ ਜਿਹੜੇ ਹੈ ਉਹ ਕਾਫ਼ੀ ਜਿਹੜੇ ਹੈ ਉਹ ਬਾਰਿਸ਼ਾਂ ਦੇ ਲਈ ਬਹੁਤ ਅੱਛੇ ਹੁੰਦੇ ਨੇ ਅਤੇ ਬਾਰਿਸ਼ਾਂ ਜਿਹੜੀਆਂ ਉਹਨਾਂ ਨਾਲ਼ ਹੀ ਮੌਸਮ ਜਿਹੜਾ ਉਹ ਚੇਂਜ ਹੁੰਦਾ ਰਹਿੰਦਾ